ਹੈਲੋ ਹਾਂਜੀ ਬਾਈ ਜੀ ਜਗਸੀਤ ਸਿੰਘ ਬੋਲਦੇ ਹੋ ਜੋਗੇ ਤੋਂ ਮੈ ਬਾਈ ਜੀ ਤੁਹਾਡਾ ਨਾ ਇੱਥੇ ਪਿੰਡ ਦੇ ਵਿੱਚ ਬਲਜਿੰਦਰ ਸਿੰਘ ਨਾਂ ਦਾ ਬੋਲਦਾ ਬੰਦਾ ਨਵਾਂ ਆਇਆ ਤੁਹਾਡੇ ਪਿੰਡ 'ਚ ਮੈਂ ਤੁਹਾਡੇ ਇੱਥੇ ਜੋਗੇ ਆਇਆ ਜੀ ਹੁਣ ਨਵਾਂ ਆਇਆ ਗਾ ਬਾਹਰੋਂ ਇੱਕ ਨਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਆਪਣੇ ਗੁਰੂ ਘਰ ਬਾਰੇ ਜਾਣਕਾਰੀ ਲੈਣੀ ਹੈ ਗੁਰੂ ਘਰ ਕਲਗੀਧਰ ਸਾਹਿਬ ਹੈ ਅਤੇ ਇੱਥੇ ਕੋਈ ਦੱਸੋ ਆਪਾਂ ਨੂੰ ਕਿ ਮਾੜਾ ਜਿਹਾ ਇਤਿਹਾਸ ਬਾਰੇ ਜਾਂ ਕੋਈ ਕੀ ਗਤੀਵਿਧੀਆਂ ਨੇਗੀਆਂ ਇੱਥੇ ਕਿਵੇਂ ਕਮੇਟੀ ਕਮੁਟੀ ਬਣੀ ਹੋਈ ਆ ਠੀਕ ਹੈ ਜੀ ਅੱਛਾ ਹਮ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ ਅਸੀਂ ਵੀ ਅਸੀਂ ਆਏ ਸੀ ਨਵੇਂ ਸਾਨੂੰ ਪਿੰਡ ਬਾਰੇ ਕੁਝ ਹੈ ਨਹੀਂ ਸੀ ਜਾਣਕਾਰੀ ਹੋਰ ਕੋਈ ਪਿੰਡ ਦੇ ਵਿੱਚ ਸਾਂਝੀਆਂ ਸੰਸਥਾਵਾਂ ਜਾਂ ਕੋਈ ਗੁਰੂ ਘਰ ਹੋਰ ਹੋਵੇ ਠੀਕ ਹੈ

ਠੀਕ ਹੈ ਜੀ ਤਾਂ ਲੋਕ ਕਿਵੇਂ ਨੇ ਇੱਥੋਂ ਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਆ ਬਾਈ ਜੀ ਇਹੀ ਜਾਣਕਾਰੀ ਲੈਣੀ ਸੀ ਤੁਹਾਤੋਂ ਧੰਨਵਾਦ ਤੁਹਾਡਾ